ਹਾਂ ਅਸੀਂ ਪੀ ਟੀ ਊਸ਼ਾ ਬਾਰੇ ਜਾਣਦੇ ਹਾਂ ਪੀ ਟੀ ਊਸ਼ਾ ਜੀ ਦਾ ਜਨਮ ਸਤਾਈ ਜੂਨ ਉੱਨੀ ਸੌ ਚੌਂਹਠ ਨੂੰ ਹੋਇਆ ਪੀ ਟੀ ਊਸ਼ਾ ਭਾਰਤ ਦੀ ਇੱਕ ਪਹਿਲੀ ਅਜਿਹੀ ਔਰਤ ਸੀ ਜੋ ਕਿ ਓਲੰਪਿਕ ਫਾਈਨਲ ਤੱਕ ਖੇਡੇ ਅਤੇ ਇਹ ਮੁਕਾਮ ਉਹਨਾਂ ਨੇ ਬਹੁਤ ਹੀ ਛੋਟੀ ਉਮਰ ਵਿੱਚ ਹਾਸਲ ਕੀਤਾ ਉਹਨਾਂ ਦੀ ਉਸ ਸਮੇਂ ਉਮਰ ਸਿਰਫ ਸੋਲ੍ਹਾਂ ਸਾਲ ਦੀ ਸੀ ਉਹਨਾਂ ਨੇ ਇਸ ਉਮਰ ਵਿੱਚ ਸੱਤ ਸਿਲਵਰ ਚਾਰ ਗੋਲਡ ਏਸ਼ੀਆ ਗੇਮ ਵਿੱਚ ਜਿੱਤੇ ਅਤੇ ਜਿਨ੍ਹਾਂ ਨੂੰ ਟਰੈਕ ਦੀ ਰਾਣੀ ਔਫ ਕਿਊਨ ਵੀ ਕਿਹਾ ਜਾਂਦਾ ਸੀ ਇਹਨਾਂ ਉਹਨਾਂ ਦੀ ਇੰਨੀ ਉਪਲੱਬਧੀ ਵਜੋਂ ਉਹਨਾਂ ਨੂੰ ਇੱਕ ਸਰਕਾਰੀ ਨੌਕਰੀ ਵੀ ਕੀਤੀ ਅਤੇ ਦੋ ਹਜ਼ਾਰ ਬਾਈ ਵਿੱਚ ਉਹ ਰਾਜ ਸਭਾ ਮੈਂਬਰ ਵੀ ਚੁਣੇ ਗਏ ਉਹਨਾਂ ਦੀ ਇਸ ਮਿਹਨਤ ਇਸ ਤੋਂ ਪਤਾ ਲੱਗਦਾ ਹੈ ਕਿ ਜੋ ਵੀ ਆਦਮੀ ਇੰਨੀ ਮਿਹਨਤ ਕਰਦਾ ਹੈ ਤਾਂ ਆਪਦੇ ਮੁਕਾਮ 'ਤੇ ਪਹੁੰਚ ਜਾਂਦਾ ਹੈ ਟੀ ਊਸ਼ਾ ਇੱਕ ਬਹੁਤ ਹੀ ਪ੍ਰਸਿੱਧ ਦੌੜਾਕ ਸਨ ਜੋ ਕਿ ਆਉਣ ਵਾਲੀ ਨਸਲਾਂ ਤੱਕ ਵੀ ਯਾਦ ਕੀਤੇ ਜਾਣਗੇ ਅਤੇ ਉਹਨਾਂ ਨੂੰ ਸੇਧ ਮਿਲੇਗੀ ਟੀ ਊਸ਼ਾ ਜੀ ਬਹੁਤ ਹੀ ਨੇਕ ਸੁਭਾਅ ਦੇ ਸਨ ਅਤੇ ਉਹਨਾਂ ਨੇ ਬਹੁਤ ਹੀ ਮਿਹਨਤ ਕੀਤੀ ਅਤੇ ਸਾਡੇ ਭਾਰਤ ਦਾ ਨਾਂ ਰੌਸ਼ਨ ਕੀਤਾ ਸਾਡੇ ਸਭ ਲਈ ਬਹੁਤ ਹੀ ਪ੍ਰੇਰਨਾਦਾਇਕ ਹਨ ਟੀ ਊਸ਼ਾ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੋ ਵੀ ਬੱਚਾ ਮਿਹਨਤ ਕਰਦਾ ਹੈ ਉਸ ਨੂੰ ਇੱਕ ਨਾ ਇੱਕ ਦਿਨ ਮੁਕਾਮ ਹਾਸਲ ਹੋ ਹੀ ਜਾਂਦਾ ਹੈ ਸਾਡੇ ਬੱਚੇ ਵੀ ਉਹਨਾਂ ਨੂੰ ਵੇਖ ਕੇ ਬਹੁਤ ਪ੍ਰੈਕਟਿਸ ਕਰਦੇ ਹਨ ਅਤੇ ਉਹਨਾਂ ਦੀ ਤਰ੍ਹਾਂ ਬਣਨਾ ਚਾਹੁੰਦੇ ਹਨ ਪੀ ਟੀ ਊਸ਼ਾ ਅੱਜ ਕੱਲ੍ਹ ਕਿਸੇ ਐਸਾ ਨਾਂ ਨ ਵੀ ਕੋਈ ਬੱਚੇ ਬੱਚੇ ਨੂੰ ਵੀ ਯਾਦ ਹੈ ਪੀ ਟੀ ਊਸ਼ਾ ਜੀ ਦਾ ਨਾਮ ਉਹਨਾਂ ਨੇ ਬਹੁਤ ਹੀ ਮਿਹਨਤ ਕਰੀ ਹੈ ਪੀ ਟੀ ਊਸ਼ਾ ਜੀ ਬਹੁਤ ਹੀ ਵਧੀਆ ਦੌੜਾਕ ਸਨ ਧੰਨਵਾਦ